ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਕਠੋਰ ਗਰਮੀ ਹੋਵੇ ਭਾਵੇਂ ਕਠੋਰ ਸਰਦੀ ਹੋਵੇ ਦੋਵੇਂ ਹੀ ਜੇ ਮੌਸਮ ਆਪਣੇ ਪੂਰੇ ਪੀਕ ਦੇ ਉੱਤੇ ਹੁੰਦੇ ਆ ਫਿਰ ਤਾਂ ਪੌਦਿਆਂ ਨੂੰ ਨੁਕਸਾਨ ਕਰਦੇ ਹੀ ਕਰਦੇ ਹੈ ਜਿਵੇਂ ਦੋ ਇਗਜਾਮਪਲ ਮੈਂ ਤੁਹਾਨੂੰ ਦਿੰਨਾ ਵੀ ਇੱਕ ਤਾਂ ਜਿਵੇਂ ਧਨੀਆ ਹੋ ਗਿਆ ਧਨੀਆ ਸਰਦੀਆਂ ਦੇ ਵਿੱਚ ਜਮਾਂ ਹੀ ਬਾਲੀ ਸਰਦੀ ਦੇ ਵਿੱਚ ਜਮਾਂ ਮੱਚ ਜਾਂਦਾ ਹੁੰਦਾ ਅਤੇ ਉਹਦੇ ਲਈ ਅਸੀਂ ਤਾਂ ਇਹੀ ਕੋਸ਼ਿਸ਼ ਕਰਦੇ ਹਾਂ ਜੀ ਧਨੀਏ ਨੂੰ ਇਹੋ ਜਿਹੀ ਥਾਂ 'ਤੇ ਲਾਈਏ ਜਿੱਥੇ ਉਹਨੂੰ ਸਨ ਸਨਲਾਈਟ ਆ ਜਿਹੜੀ ਸੂਰਜ ਦੀ ਕਿਰਨਾਂ ਹੈ ਉਹ ਵੱਧ ਤੋਂ ਵੱਧ ਮਿਲੇ ਅਤੇ ਜ਼ਿਆਦਾ ਟਾਈਮ ਤੱਕ ਮਿਲੇ ਪੂਰੇ ਦਿਨ ਦੇ ਵਿੱਚ ਆਏ ਨਾ ਹੋਏ ਵੀ ਉਹਦੇ ਆਸੇ ਪਾਸੇ ਕੋਈ ਪੇੜ ਲੱਗਿਆ ਦੂਜਾ ਜਾਂ ਕੋਈ ਦੀਵਾਰ ਖੜ੍ਹੀ ਹੈ ਉਹ ਦੀ ਉਹ ਛਾਂ ਦੇ ਵਿੱਚ ਆ ਗਿਆ ਅਤੇ ਉਹਨੂੰ ਧੁੱਪ ਜਿਹੜੀ ਹੈ ਉਹ ਪ੍ਰੋਪਰ ਮਿਲੀ ਨਹੀਂ ਧਨੀਏ ਨੂੰ ਇਹਦਾ ਧਿਆਨ ਰੱਖਣਾ ਵੀ ਉਹਨੂੰ ਧੁੱਪ ਵੱਧ ਤੋਂ ਵੱਧ ਮਿਲੇ ਦੂਜੀ ਜਿਵੇਂ ਹੋ ਗਈ ਜੀ ਸ਼ਿਮਲਾ ਮਿਰਚ ਉਹ ਗਰਮੀਆਂ ਦੇ ਵਿੱਚ ਬਾਲੀ ਗਰਮੀ ਪੈਂਦੀ ਹੈ ਤਾਂ ਸ਼ਿਮਲਾ ਮਿਰਚ ਛੇਤੀ ਖਰਾਬ ਹੁੰਦੀ ਹੈ ਅਤੇ ਉਹਨੂੰ ਪੂਰਾ ਪਾਣੀ ਦਾ ਛਿੜਕਾਵ ਕਰਦੇ ਰਹੋ ਉਹਨੂੰ ਪ੍ਰੋਪਰ ਪਾਣੀ ਦੀ ਜਮਾਂ ਹੀ ਕਮੀ ਨਾ ਆਉਣ ਦੋ ਸ਼ਿਮਲਾ ਮਿਰਚ ਦੇ ਪੌਦੇ ਨੂੰ ਅਤੇ ਦੂਜੀ ਗੱਲ ਜਿਵੇਂ ਸ਼ਿਮਲਾ ਮਿਰਚ ਉਹਦੇ 'ਤੇ ਲੱਗੇ ਲੱਗਣ ਤੋਂ ਬਾਅਦ ਉਹਨੂੰ ਜ਼ਿਆਦਾ ਵੇਟ ਨਾ ਕਰੋ ਉਹਨੂੰ ਤੋੜ ਲਓ ਤੁਸੀਂ ਨਹੀਂ ਤਾਂ ਉਹ ਫਿਰ ਬਾਲੀ ਗਰਮੀ ਦੇ ਵਿੱਚ ਖਰਾਬ ਹੋ ਜਾਂਦੀ ਹੈ ਧੰਨਵਾਦ ਜੀ